ਘਰੇਲੂ ਬਿਜਲੀ ਤੋਂ ਖਤਰਾ ਕਰੰਟ ਲੱਗਣ ਦਾ ਹੁੰਦਾ ਹੈ ਸਾਨੂੰ ਹਮੇਸ਼ਾ ਲਾਈਨ ਟੈਸਟ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਪਤਾ ਚਲ ਜਾਵੇ ਕਿ ਤਾਰ ਵਿੱਚ ਕਰੰਟ ਤਾਂ ਨਹੀਂ ਹੈ ਉਸ ਦੀ ਲਾਈਟ ਜਗ ਜਾਂਦੀ ਹੈ ਤੇ ਅਸੀਂ ਸੁਚੇਤ ਹੋ ਕੇ ਕੰਮ ਕਰਦੇ ਹਾਂ ਸੋ ਕੋਈ ਵੀ ਬਿਜਲੀ ਦਾ ਕੰਮ ਕਰਨ ਤੋਂ ਪਹਿਲਾਂ ਸਾਨੂੰ ਮੇਨ ਸਵਿਚ ਆਫ ਕਰ ਦੇਣਾ ਚਾਹੀਦਾ ਹੈ ਬਿਜਲੀ ਦੇ ਉਪਕਰਨਾ ਤੇ ਕੰਮ ਕਰਨ ਤੋਂ ਪਹਿਲਾਂ ਸਾਨੂੰ ਬਿਜਲੀ ਬਾਰੇ ਪੂਰਾ ਗਿਆਨ ਹੋਣਾ ਚਾਹੀਦਾ ਹੈ ਤਾਂ ਕੀ ਦੁਰਘਟਨਾ ਤੋਂ ਬਚਿਆ ਜਾ ਸਕੇ ਜੇਕਰ ਕੋਈ ਆਦਮੀ ਕਰੰਟ ਦਾ ਸ਼ਿਕਾਰ ਹੋ ਜਾਵੇ ਤਾਂ ਸਾਨੂੰ ਉਸਨੂੰ ਲੱਕੜ ਦੇ ਸਹਾਰੇ ਬਿਜਲੀ ਦੇ ਉਪਕਰਨ ਤੋਂ ਹਟਾਣਾ ਚਾਹੀਦਾ ਹੈ ਤਾਂ ਕੀ ਉਸਦੀ ਜਾਨ ਬਚ ਸਕੇ